ਦੋ ਫਰਵਰੀ ਦੋ ਹਜ਼ਾਰ ਚਾਰ ਸਤਾਰਾਂ ਜਨਵਰੀ ਦੋ ਹਜ਼ਾਰ ਤੇਰਾਂ ਨੌਂ ਅਗਸਤ ਦੋ ਹਜ਼ਾਰ ਦੋ ਪੰਝੀ ਦਸੰਬਰ ਦੋ ਹਜ਼ਾਰ ਬਾਈ ਸ ਸੱਤ ਮਾਰਚ ਦੋ ਹਜ਼ਾਰ ਛੇ